ਡਾਂਸ ਡਾਂਸ ਇੱਕ ਬਹੁਤ ਵਧੀਆ ਪ੍ਰਕਿਰਿਆ ਹੈ ਜਿਸ ਦੇ ਰਾਹੀਂ ਅਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਜੋ ਕੁਛ ਚੱਲ ਰਿਹਾ ਉਹ ਦੱਸ ਸਕਦੇ ਹਾਂ ਡਾਂਸ ਰਾਹੀਂ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਕਿਉਂਕਿ ਡਾਂਸ ਨਾਲ ਕਰ ਕਰਨ ਨਾਲ ਹੱਥ ਪੈਰ ਚੱਲਦੇ ਰਹਿੰਦੇ ਹਨ ਅਤੇ ਆਲਸਪਣ ਬਹੁਤ ਦੂਰ ਹੋ ਜਾਂਦਾ ਹੈ ਹੈ ਨਾ ਡਾਂਸ ਕਰਦੇ ਸਮੇਂ ਸਾਨੂੰ ਖੁਸ਼ੀ ਹੈਪੀ ਬਹੁਤ ਖੁਸ਼ੀ ਮਿਲਦੀ ਹੈ ਹੈ ਨਾ ਡਾਂਸ ਇੱਕ ਬਹੁਤ ਹੀ ਚੰਗੀ ਪ੍ਰਕਿਰਿਆ ਹੈ ਜਿਹਦੇ ਰਾਹੀਂ ਅਸੀਂ ਤੰਦਰੁਸਤ ਅਤੇ ਖੁਸ਼ ਵੀ ਰਹਿ ਸਕਦੇ ਹਾਂ ਡਾ ਡਾਂਸ ਦੇ ਸਟੈਪ ਬਹੁਤ ਹੀ ਜ਼ਿਆਦਾ ਵਧੀਆ ਹਨ ਜਿਹਦੇ ਰਾਹੀਂ ਅਸੀਂ ਸਾਹਮਣੇ ਬੈਠੇ ਨੂੰ ਦੱਸ ਸਕਦੇ ਹਾਂ ਕਿ ਅਸੀਂ ਸਾਡੀ ਜ਼ਿੰਦਗੀ ਕਿੰਨੀ ਹੀ ਖੁਸ਼ ਹੈ ਅਸੀਂ ਪਿੱਛੇ ਆਪਣੀ ਜ਼ਿੰਦਗੀ ਤੋਂ ਕਿੰਨਾ ਖੁਸ਼ ਹਾਂ ਅਸੀਂ ਆਪਣੇ ਅਸੀਂ ਡਾਂਸ ਤੋਂ ਬਹੁਤ ਕੁਛ ਸਿੱਖਦੇ ਹਾਂ ਡਾਂਸ ਇਕ ਬਹੁਤ ਹੀ ਜ਼ਿਆਦਾ ਵਧੀਆ ਪਿਰਕ ਰਿਹਾ ਹੈ ਡਾਂਸ ਕਰਦੇ ਸਮੇਂ ਸਾਨੂੰ ਆਸੇ ਪਾਸੇ ਕੁਛ ਮਤਲਬ ਦਿਖਦਾ ਨਹੀਂ ਹੈ ਸਾਨੂੰ ਬਸ ਐਂ ਲੱਗਦਾ ਹੈ ਕਿ ਅਸੀਂ ਡਾਂਸ ਹੀ ਡਾਂਸ ਕਰਨਾ ਹੈ ਡਾਂਸ ਨੂੰ ਬਹੁਤ ਹੀ ਵਧੀਆ ਪੱਧਰ 'ਤੇ ਮੰਨਿਆ ਜਾਂਦਾ ਹੈ ਡਾਂਸ ਡਾਂਸ ਕਰਦੇ ਸਮੇਂ ਬਹੁਤ ਤ ਪ੍ਰਕਿਰਿਆ ਦੇ ਡਾਂਸ ਆ ਗਏ ਹਨ ਜਿਵੇਂ ਬਹੁਤ ਸਾਰੇ ਜਿਵੇਂ ਭੰਗੜਾ ਗਿੱਧਾ ਲੋ ਓ ਲੋਕ ਨਾਚ ਹੋ ਗਿਆ ਪੰਜਾਬੀ ਸੋਂਗ 'ਤੇ ਡਾਂਸ ਕਰਨਾ ਬਹੁਤ ਹੀ ਜ਼ਿਆਦਾ ਵਧੀਆ ਅੱਜ ਕੱਲ੍ਹ ਬਹੁਤ ਜ਼ਿਆਦਾ ਵਧੀਆ ਪ੍ਰਕਿਰਿਆ ਹੋ ਗਈ ਏ ਡਾਂਸ ਦੀ ਡਾਂਸ ਨੂੰ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਡਾਂਸ ਸਾਨੂੰ ਬਹੁਤ ਕੁਛ ਸਿਖਾਉਂਦਾ ਹੈ ਡਾਂਸ ਕਰਦੇ ਸਮੇਂ ਸਾਨੂੰ ਕੁਛ ਨਹੀਂ ਯਾਦ ਰਹਿੰਦਾ ਡਾਂਸ ਸਾਨੂੰ ਬਹੁਤ ਵਧੀਆ ਹੀ ਲੱਗਦਾ ਹੈ ਡਾਂਸ ਸਾਨੂੰ ਬਹੁਤ ਚੰਗਾ ਲੱਗਦਾ ਹੈ ਡਾਂਸ ਕਰਦੇ ਸਮੇਂ ਸਾਨੂੰ ਕੁਛ ਵੀ ਨਹੀਂ ਪਤਾ ਲੱਗਦਾ ਕਿ ਸਾਹਮਣੇ ਵਾਲਾ ਸਾਡੇ ਵੱਲ ਦੇਖ ਰਿਹਾ ਹੈ ਜਾਂ ਕੋਈ ਹੱਸ ਰਿਹਾ ਹੈ ਸਾਡੇ ਵੱਲ ਦੇਖ ਕੇ ਜਾਂ ਕੋਈ ਮਜ਼ਾਕ ਉਡਾ ਰਿਹਾ ਕੁਛ ਡਾਂਸ ਕਰਦੇ ਸਮੇਂ ਬਸ ਐਵੇਂ ਲੱਗਦਾ ਹੈ ਕਿ ਬਸ ਡਾਂਸ ਹੀ ਡਾਂਸ ਡਾਂਸ ਹੀ ਡਾਂਸ ਕਰਦੇ ਰਹੋ ਡਾਂਸ ਕਰਨਾ ਬਹੁਤ ਵਧੀਆ ਐਕਸਰਸਾਈਜ਼ ਡਾਂਸ ਕਰਨ ਨੂੰ ਬਹੁਤ ਵਧੀਆ ਐਕਸਰਸਾਈਜ਼ ਮੰਨਿਆ ਜਾਂਦਾ ਹੈ ਡਾਂਸ ਕਰਨ ਨਾਲ ਬਹੁਤ ਤੰਦਰੁਸਤ ਚੁਸਤ ਰਹਿੰਦਾ ਹੈ ਬੰਦਾ ਕੋਈ ਸਟਰੈਸ ਨਹੀਂ ਰਹਿੰਦਾ ਹ ਖੁਸ਼ ਮਿਸਾਜ ਬੰਦਾ ਹੋ ਜਾਂਦਾ ਹੈ ਡਾਂਸ ਨਾਲ ਬਹੁਤ ਹੀ ਵਧੀਆ ਪ੍ਰਕਿਰਿਆ ਮੰਨੀ ਜਾਂਦੀ ਹੈ